ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਤੁਸੀਂ ਸੁਣਾਓ ਬੱਸ ਐਵੇਂ ਚੱਲੀ ਜਾਂਦੀ ਹੈ ਮੇਰੀ ਫ਼ਸਲ ਹੈ ਨਾ ਐਤਕੀਂ ਵਧੀਆ ਜੀ ਨਹੀਂ ਗਈ ਉਹ ਇਸ ਵਾਰ ਨਾ ਥੋੜ੍ਹੀ ਪੈਸੇ ਦੀ ਤੰਗੀ ਸੀਗੀ ਤਾਂ ਵਧੀਆ ਬੀਜ ਨਹੀਂ ਖਰੀਦੇ ਮੈਂ ਉਹ ਮੇਰਾ ਰਿਸ਼ਤੇਦਾਰ ਕੋਈ ਹਸਪਤਾਲ ਦਾਖਲ ਸੀ ਸਾਰੇ ਪੈਸੇ ਮੇਰੇ ਉੱਧਰ ਲੱਗ ਗਏ ਹਾਂਜੀ ਇਹ ਤਾਂ ਬੱਸ ਰੱਬ ਦੇ ਹੱਥ ਹੀ ਹੈ ਅਸੀਂ ਕੀ ਕਰੀਏ ਮੈਂ ਸੁਣਿਆ ਤਾਂ ਹੈ ਕਿ ਇਹ ਇਸ ਨਾਲ ਫਸਲ ਦੀ ਪੈਦਾਵਾਰ ਵੱਧ ਜਾਂਦੀ ਹੈ ਮੈਨੂੰ ਹਜੇ ਚੰਗੀ ਤਰ੍ਹਾਂ ਪਤਾ ਨਹੀਂ ਹੈ ਤੁਸੀਂ ਮੈਨੂੰ ਦੱਸ ਸਕਦੇ ਹੋ ਉਹਦੀ ਲੋਕੇਸ਼ਨ ਬਾਰੇ ਅੱਛਾ ਜੀ

ਇਸ ਦਾ ਕੋਈ ਸੰਬੰਧ ਪਾਣੀ ਨਾਲ ਵੀ ਹੈਗਾ ਸਿੰਚਾਈ ਨਾਲ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਜੀ ਹਾਂਜੀ ਹਾਂਜੀ ਅੱਛਾ ਜੀ ਧੰਨਵਾਦ ਜੀ ਇਹ ਗੱਲ ਕਰਨ ਲਈ ਮੈਨੂੰ ਜੇ ਜੇ ਲੋੜ ਪਈ ਤਾਂ ਮੈਂ ਦੁਬਾਰਾ ਫੋਨ ਕਰ ਲਵਾਂਗਾ ਠੀਕ ਹੈ ਜੀ ਧੰਨਵਾਦ ਜੀ